ਸਾਡੇ ਕੋਲ ਕਪਿਲ ਸ਼ਰਮਾ ਦਾ ਸ਼ੋਅ ਹੈ ਇਹ ਇੱਕ ਕਾਮੇਡੀ ਸ਼ੋਅ ਹੈ ਅਸੀਂ ਸਾਰਾ ਪਰਿਵਾਰ ਇਕੱਠੇ ਦੇਖਦੇ ਹਾਂ ਅਤੇ ਇਹ ਹਾਸ ਮਨੋਰੰਜਨ ਅਤੇ ਹਾਸਾ ਮਜ਼ਾਕ ਵਾਲਾ ਸਾਧਨ ਹੈ